ਹੈਲੋ ਹਾਂਜੀ ਅੱਛਾ ਅੱਛਾ ਨਹੀਂ ਤੁਸੀਂ ਐਥੇ ਰਹਿਣਾ ਐ ਜਾਂ ਮਤਲਬ ਵੈਸੇ ਈ ਰੈਸਟੋਰੈਂਟ ਦੇਖਣਾ ਕੋਈ ਅੱਛਾ ਨਈਂ ਨਈਂ ਐਥੇ ਹੋਟਲ ਬਹੁਤ ਅੱਛੇ ਅੱਛੇ ਹੈਗੇ ਨੇ ਤਿੰਨ ਚਾਰ ਬੜੇ ਵਧੀਆ ਨੇ ਜਿਵੇਂ ਹੋਮ ਸਟੱਡ ਹੈਗਾ ਐ ਇੱਕ ਐਥੇ ਨਵਾਂ ਬਨਿਆ ਐ ਹੁਣ ਇੱਕ ਬਲੈਸਿੰਗ ਬੈੱਲ ਹੈਗਾ ਇੱਕ ਨਵਾਂ ਬਣਿਆ ਐ ਬਲੈਕ ਈਗਲ ਉਹ ਵੀ ਰੈਸਟੋਰੈਂਟ ਬਹੁਤ ਵਧੀਆ ਹੋਟਲ ਕਮ ਰੈਸਟੋਰੈਂਟ ਹੈਗਾ ਥੱਲੇ ਰੈਸਟੋਰੈਂਟ ਐ ਉਨ੍ਹਾਂ ਦਾ ਉੱਪਰ ਹੋਟਲ ਰੂਮ ਹੈਗੇ ਨੇ ਉਨ੍ਹਾਂ ਦੇ ਬੜੇ ਵਧੀਆ ਹਾਂ ਖਾਣਾ ਬਹੁਤ ਵਧੀਆ ਪਿਓਰ ਸ਼ਾਕਾਹਾਰੀ ਵੀ ਮਿਲਜੇਗਾ ਹਰ ਤਰ੍ਹਾਂ ਦਾ ਫਸਕਲਾਸ ਖਾਣਾ ਉਨ੍ਹਾਂ ਕੋਲ ਉਨ੍ਹਾਂ ਦੇ ਜਿਹੜੇ ਸ਼ੈਫ ਆਏ ਨੇ ਉਹ ਬਾਹਰੋਂ ਆਏ ਨੇ ਦਿੱਲੀ ਤੋਂ ਕਿਸੇ ਚੰਗੇ ਹੋਟਲ ਤੋਂ ਖਾਣਾ ਖੂਣਾ ਬਹੁਤ ਵਧੀਆ ਉਨ੍ਹਾਂ ਦਾ ਤੇ ਹਾਂ ਪਿਓਰ ਪਿਓਰ ਵੈਜੀ ਪਿਓਰ ਵੈਜੀ ਪਿਓਰ ਵੈਜੀ ਏ ਹਾਂ ਵਧੀਆ ਬੰਦੇ ਨੇ ਆਪਣੇ ਜਾਣਕਾਰ ਨੇ ਜੇ ਤੁਸੀਂ ਐਥੇ ਲੈਣਾ ਰੂਮ ਰਾਮ ਤਾਂ ਮੈਂ ਉਹਨੂੰ ਕਹਿ ਦਿੰਨਾ ਤੇ ਉਨ ਦਾ ਹਾਂ ਬਸ ਉਹ ਰੈਂਟ ਜਿਵੇਂ ਆਮ ਲੋਕਾਂ ਕੋਲੋਂ ਲੈਂਦੇ ਤਿੰਨ ਹਜਾਰ ਪੈਂਤੀ ਸੌ ਪਰ ਆਪਾਂ ਉਹਨੂੰ ਕਹਾਂਗੇ ਤੇ ਉਹ ਪੱਚੀ ਸੌ ਰੁਪਏ ਦੇ ਵਿੱਚ ਆਪਣਾ ਹੋਜੇਗਾ ਤੁਸੀਂ ਦੋ ਢਾਈ ਦਿਨ ਲਾ ਸਕਦੇ ਓ ਅਗਲੇ ਦਿਨ ਈ ਇੱਕ ਦੋ ਵਜੇ ਤੁਸੀਂ ਚੈੱਕ ਆਊਟ ਕਰੋਗੇ ਤੀਜੇ ਦਿਨ ਜਿਸ ਵੇਲੇ ਢਾਈ ਦਿਨ ਹੋ ਜਾਣਗੇ ਤੇ ਉਹ ਪੰਜ ਹਜਾਰ ਲਵੇਗਾ ਬਾਕੀ ਜਿਹੜਾ ਖਾਣ ਪੀਣ ਦਾ ਬਿੱਲ ਹੋਏਗਾ ਉਹ ਅਲੱਗ ਤੋਂ ਦੇਣਾ ਪਏਗਾ ਮਤਲਬ ਹਾਂ ਬਸ ਐਨਾ ਈ ਐ ਵੀ ਉਂਜ ਉਨ੍ਹਾਂ ਦਾ ਰੋਡ ਵੀ ਵਧੀਆ ਐ ਤੇ ਤੁਹਾਡੀ ਗੱਡੀ ਗੁੱਡੀ ਵੀ ਓਥੇ ਪਾਰਕਿੰਗ ਸੁਵਿਧਾ ਬੜੀ ਵਧੀਆ ਐ ਗੱਡੀ ਨਈਂ ਨਾਲ ਲਿਆਏ ਉਹ ਟੈਕਸੀ ਆਲਾ ਹੈਗਾ ਐ ਉਹ ਚਲਾ ਜਾਵੇ ਤੇ ਉਨ੍ਹਾਂ ਕੋਲ ਵੀ ਓਥੇ ਅਵੇਲੇਬਲ ਹੈਗੀ ਏ ਗੱਡੀ ਉਨ੍ਹਾਂ ਦੀ ਕਿਤੇ ਆਣਾ ਜਾਣਾ ਹੋਵੇ ਤਾਂ ਉਹ ਭੇਜ ਦਿੰਦੇ ਨਾਲ ਹਰ ਸੁਵਿਧਾ ਓਥੇ ਤੁਹਾਨੂੰ ਮਿਲਜੇਗੀ ਹਾਂ ਠੀਕ ਐ ਕੋਈ ਗੱਲ ਨੀ ਤੁਹਾਡਾ ਜੋ ਮੈਂ ਓਥੇ ਜਾਨਾ ਕਰਾ ਦਿੰਨਾ ਤੁਹਾਡੇ ਨਾਂਅ ਤੇ ਬੁੱਕ